ਅੱਜ ਕੱਲ੍ਹ ਸਾਰੇ ਹੀ ਇਲਾਕੇ ਵਿੱਚ ਹਰੇਕ ਬੈਂਕ ਦੀਆਂ ਬ੍ਰਾਂਚਾਂ ਖੋਲ੍ਹੀਆਂ ਹੋਈਆਂ ਹਨ ਸਾਡੇ ਇਲਾਕੇ ਵਿੱਚ ਵੀ ਤਕਰੀਬਨ ਤਕਰੀਬਨ ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਜਿਵੇਂ ਕਿ ਐੱਸ ਬੀ ਆਈ ਐੱਚ ਡੀ ਐੱਫ ਸੀ ਪੰਜਾਬ ਐਂਡ ਸਿੰਧ ਬੈਂਕ ਹੈ ਸਾਰੀਆਂ ਬ੍ਰਾਂਚਾਂ ਆਪਣੇ ਆਪ ਵਿੱਚ ਮੰਨੀਆਂ ਪਰਵੰਨੀਆਂ ਬ੍ਰਾਂਚਾਂ ਨੇ ਅਤੇ ਇਹਨਾਂ ਵਿੱਚੋਂ ਮੇਰੀ ਮਨ ਬ੍ਰਾਂਚ ਐੱਸ ਬੀ ਆਈ ਬੈਂਕ ਹੈ ਜਿਸ ਵਿੱਚ ਮੇਰਾ ਖਾਤਾ ਹੈ ਇਹ ਬਹੁਤ ਹੀ ਸ ਸੁਵਿਧਾ ਪ੍ਰਦਾਨ ਕਰਨ ਵਾਲਾ ਬੈਂਕ ਹੈ ਜਿਵੇਂ ਇੰਟਰਨੈਟ ਬੈਂਕਿੰਗ ਇਨਸ਼ੋਰੈਂਸ ਪੋਲਿਸੀ ਅਤੇ ਬਾਕੀ ਇੱਥੋਂ ਦਾ ਸਟਾਫ ਦਾ ਨੇਚਰ ਵੀ ਬਹੁਤ ਫਰੈਂਡਲੀ ਆ ਜਦੋਂ ਵੀ ਬੈਂਕ ਜਾਈਦਾ ਤਾਂ ਬਹੁਤ ਹੀ ਨੇਚਰ ਨਾਲ ਮਿਲਦੇ ਨੇ ਇਹ ਅਤੇ ਇੱਕ ਇਹਨਾਂ ਦੀ ਇਨਸ਼ੋਰੈਂਸ ਪੋਲਸੀ ਦੀ ਸਕੀਮ ਹੈ ਕਿ ਤਿੰਨ ਸੌ ਇਕਵੰਜਾ ਰੁਪਏ ਆਪਾਂ ਸਾਲ ਦੇ ਭਰਨੇ ਆ ਅਗਰ ਪੰਜਾਹ ਸਾਲ ਤੋਂ ਪਹਿਲਾਂ ਡੈਥ ਹੋ ਜਾਂਦੀ ਹੈ ਤਾਂ ਤੁਹਾਨੂੰ ਪੰਜ ਲੱਖ ਰੁਪਏ ਦਾ ਇਨਸ਼ੋਰੈਂਸ ਮਿਲੇਗਾ